ਸਤਿ ਸ਼੍ਰੀ ਅਕਾਲ ਸਰ ਮੇੇਰਾ ਨਾਮ ਆਰਤੀ ਹੈ ਮੈਂ ਪਠਾਨਕੋਟ ਤੋਂ ਬੋਲਦੀ ਐਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਕਿ ਪੰਜਾਬੀ ਸੰਗੀਤ ਦੇ ਬੋਲਣ ਵਿੱਚ ਕੁਝ ਆਮ ਵਿਸ਼ੇ ਹੈਗੇ ਹਨ ਜਿਵੇਂ ਕਿ ਪੰਜਾਬੀ ਸੰਗੀਤ ਵਿੱਚ ਗੀਤਾਂ ਅਤੇ ਬੋਲ ਕਈ ਵੇਲੇ ਲੋਕ ਸੰਗੀਤ ਦੀ ਆਦਤਾਂ ਪ੍ਰਨਾਂਵਾਂ ਅਤੇ ਸਮਾਜਿਕ ਮੁੱਦਿਆਂ ਦੇ ਅਵਸਥਾ ਦੇਣਾ ਵੀ ਸੀ ਨੇ ਸੰਗੀਤ ਨੂੰ ਵਿਚਾਰ ਕਰਨ ਦਾ ਇੱਕ ਬਹੁਤ ਤਕ ਸੰਗਟ ਗਠਨ ਹੈ ਜੋ ਸਮਾਜਿਕ ਅਤੇ ਸਾਂਝੀ ਅਨੋ ਅਨੁਭਵ ਦੇ ਸਵਰੂਪ ਕਰਨ ਦਾ

ਰੱਖਦਾ ਹੈ ਇਹ ਗੀਤ ਸਮਾਂ ਅਤੇ ਕੁਲਰ ਦੀ ਵਿਧਾਤਾ ਨੂੰ ਦਰਸਾਉਂਦੇ ਹਨ

ਆਧੁਨਿਕ ਸਮਾਜ ਦੇ ਮੂਹਰੇ ਪਹਿਲੂਆਂ ਨੂੰ ਵੀ ਸਹਾਇਤਕ ਰੂਪ ਵਿੱਚ ਪੇਸ਼ ਕਰਦੇ ਹਨ ਇਹ ਕੁਝ ਪੰਜਾਬੀ ਸੰਗੀਤ ਦੇ ਬੋਲ ਹਨ ਭੰਗੜਾ ਪੰਜਾਬੀ ਲੋਕ ਸੰਗੀਤ ਦਾ ਇੱਕ ਪ੍ਰਮੁੱਖ ਰੂਪ ਜਿਸ ਵਿੱਚ ਸਤੋਰਤ ਬੋਲ ਬੋਲ ਅੰਦੇਲੇ ਸ਼ੈੱਲੀ ਦੇ ਤੌਰ ਗਾਏ ਜਾਂਦੇ ਹਨ ਇਸ ਦਾ ਮੁੱਖ ਉਪਦੇਸ਼ ਪਰਲ ਬੰਦੇ ਦੀ ਖੁਸ਼ੀ ਵਿੱਚ ਉਤਸ਼ਾਹ ਨੂੰ ਸ਼ਾਮਲ ਕਰਨਾ ਹੈ ਗਿੱਧਾ ਇਹ ਵਿਆਹ ਅਤੇ ਉਤਸਵ ਵਿੱਚ ਗਾਇਕਾ ਗਾਇਆ ਜਾਂਦਾ ਹੈ ਅਤੇ ਇਸ ਦਾ ਮੁੱਖ ਉਦੇਸ਼ ਮਨੋਰੰਜਨ ਅਤੇ ਸਮਾਜਿਕ ਇਕੱਤਰਤਾ ਸਥਾਨ ਹੈ